ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਫੂਡ ਬਲੋਗਰ ਬੋਲ ਰਹੀ ਹਾਂ ਜੀ ਯੂਟਿਊਬ ਚੈਨਲ ਤੋਂ ਹਾਂਜੀ ਮੈਂ ਤੁਹਾਡੀ ਹੈਲਪ ਲੈਣਾ ਚਾਵਾਂਗੀ ਵੀ ਤੁਸੀਂ ਪੰਜਾਬ ਦੇ ਲੋ ਪੰਜਾਬ ਦੇ ਲੋਕਾਂ ਨੂੰ ਕੀ ਕੀ ਪਸੰਦ ਹੈ ਮੈਮ ਉਥੇ ਮੈਂ ਉਹ ਬਣਾਉਣਾ ਜੀ ਬਲੋਗ ਬਣਾਉਣਾ ਹੈ ਜੀ ਉਹਦੇ ਬਾਰੇ ਜਾਨਣਾ ਚਾਹਾਂਗੀ ਤੁ ਕੀ ਤੁਸੀਂ ਮੈਨੂੰ ਦੱਸ ਸਕਦੇ ਹਾਂ ਦੱਸੋ ਜੀ ਕੀ ਕੀ ਪਸੰਦ ਹੈ ਲੋਕਾਂ ਨੂੰ ਪੰਜਾਬ ਦਿਆਂ ਨੂੰ ਓਕੇ ਓਕੇ ਮੈਮ ਸਾਗ ਮੱਕੀ ਦੀ ਰੋਟੀ ਜ਼ਿਆਦਾ ਪਸੰਦ ਹੈ ਓਕੇ ਜੀ ਹਾਂਜੀ ਓਕੇ ਜੀ ਓਕੇ ਠੀਕ ਹੈ ਡਰਿੰਕ ਵਗੇ ਡਰਿੰਕ 'ਚ ਇਹ ਪਸੰਦ ਕਰਦੇ ਨੇ ਮਤਲਬ ਪੀਣਾ ਅੱਛਾ ਅੱਛਾ ਜੀ ਓਕੇ ਜੀ ਗਰਮੀ ਗਰਮੀ 'ਚ ਦੱਸੋਗੇ ਜੀ ਗਰਮੀ 'ਚ ਕੀ ਪਸੰਦ ਕਰਦੇ ਅੱਛਾ ਜੀ ਅੱਛਾ ਜੀ ਵਾਹ ਜੀ ਅੱਛਾ ਓਕੇ ਮੈਮ

ਓਕੇ ਮੈਮ ਓਕੇ ਜੀ ਓਕੇ ਮੈਮ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ